ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਿਲਕੁਲ ਜੀ ਔਰਗੈਨਿਕ ਤਾਜ਼ਾ ਸਬਜ਼ੀਆਂ ਮਿਲਦੀਆਂ ਨੇ ਜੀ ਹਾਂਜੀ ਅਸੀਂ ਜੀ ਅਲੱਗ ਅਲੱਗ ਪਿੰਡਾਂ ਵਿੱਚ ਜਿਹੜੇ ਕਿਸਾਨ ਹੁੰਦੇ ਹਨ ਜੁੜੇ ਹੋਏ ਨੇ ਸਾਡੇ ਨਾਲ ਉਹਨਾ ਨੂੰ ਕੋਂਟੈਕਟ ਕਰਦੇ ਹਾਂ ਜੋ ਘਰ ਵਿਚ ਆਰਗੈਨਿਕ ਸਬਜ਼ੀਆਂ ਬੀਜਦੇ ਹਨ ਉਹਨਾਂ ਨੂੰ ਅਸੀਂ ਕੋਂਟੈਕਟ ਕਰਦੇ ਹਾਂ ਅਤੇ ਉਹਨਾਂ ਤੋਂ ਸਬਜ਼ੀਆਂ ਮੰਗਵਾਉਂਦੇ ਹਾਂ ਜੀ ਬਿਲਕੁਲ ਤਾਜ਼ੀਆ ਜੀ ਫਰੈਸ਼ ਹਾਂਜੀ ਹਾਂਜੀ

ਹਾਂਜੀ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਦੱਸੋ ਕਿਹੜੀ ਸਬਜ਼ੀ ਚਾਹੀਦੀ ਤੁਹਾਨੂੰ ਕਿਹੜੀ ਕਿਹੜੀ ਸਬਜ਼ੀ ਚਾਹੀਦੀ ਹੈ ਜੀ ਸਾਡੇ ਕੋਲ ਭਿੰਡੀ ਆ ਗੋਭੀ ਆ ਆਲੂ ਆ ਪਿਆਜ਼ ਆ ਸ਼ਿਮਲਾ ਮਿਰਚ ਆ ਬੈਂਗਣੀ ਹੈ ਪੱਤ ਗੋਭੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਜ਼ਰੂਰ ਮਿਲ ਜਾਣਗੀਆਂ ਇਕੱਲੀ ਇਕੱਲੀ ਬਿਲਕੁਲ ਫਰੈਸ਼ ਸਬਜ਼ੀਆਂ ਤੁਹਾਨੂੰ ਹਾਂਜੀ ਜੀ ਹਾਂਜੀ ਕਰੇਲੇ ਵਗੈਰਾ ਨੇ ਜੀ ਮਟਰ ਨੇ ਜੀ ਹਰੇ ਮਟਰ ਲਾਲ ਟਮਾਟਰ ਹਾਂਜੀ ਬਿਲਕੁਲ ਮਿਲਜੂ ਜੀ ਜ਼ਰੁਰ ਟਾਈਮ ਤੁਹਾਨੂੰ ਹਾਂਜੀ ਤੁਹਾਡੀ ਸਬਜ਼ੀ ਤੁਹਾਨੂੰ ਤਾਜ਼ੀ ਜ਼ਰੂਰ ਮਿਲ ਜੂਗੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਤਾਜ਼ੀ ਸਬਜ਼ੀ ਮਿਲਜੂ ਜੀ ਤੁਹਾਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ